ਹਾਂਜੀ ਸੈਲਫ ਹੈਲਪ ਗਰੁੱਪ ਔਰਤਾਂ ਦੇ ਲਈ ਕੁਝ ਰੁਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰਦਾ ਹੈ ਜਿਸ ਵਿੱਚ ਇੱਕ ਪਿੰਡ ਦੇ ਵਿੱਚ ਜਾਂ ਸ਼ਹਿਰ ਦੀ ਇੱਕ ਛੋਟੇ ਜਿਹੇ ਹਿੱਸੇ ਵਿੱਚ ਇਸ ਐਸ ਐਚ ਜੀ ਸੈਲਫ ਹੈਲਪ ਗਰੁੱਪ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਜਿਸ ਵਿੱਚ ਕਾਫੀ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਆਪਣਾ ਗਰੁੱਪ ਬਣਾਉਂਦੀਆਂ ਹਨ ਮਹੀਨਾਵਾਰ ਰਾਸ਼ੀ ਇਹਨਾਂ ਗਰੁੱਪਾਂ ਦੇ ਵਿੱਚ ਇਕੱਠੀ ਹੋ ਕੇ ਜਿਸ ਔਰਤ ਨੂੰ ਮਦਦ ਦੀ ਲੋੜ ਹੋਵੇ ਉਸ ਵਿੱਚ ਦਿੱਤੀ ਜਾਂਦੀ ਹੈ ਕੁਝ ਚੰਗੇ ਮੌਕੇ ਉਸ ਵਿੱਚ ਇਨਾਮ ਪ੍ਰਦਾਨ ਕਰਦੇ ਹਨ ਇਹਨਾਂ ਚੰਗਿਆਂ ਮੌਕਿਆਂ ਰਾਹੀਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਸਵੈਟਰ ਬੁਣਨਾ ਸਵੈਟਰ ਬੁਣਨ ਦੀਆਂ ਮਸ਼ੀਨਾਂ ਅਤੇ ਹੋਰ ਘਰੇਲੂ ਉਦਯੋਗਾਂ ਦੇ ਲਾਉਣ ਵਿੱਚ ਮਦਦ ਮਿਲਦੀ ਹੈ ਇਸ ਦੀ ਰਾਸ਼ੀ ਬਹੁਤ ਹੀ ਸਰਲ ਅਤੇ ਆਸਾਨ ਢੰਗ ਨਾਲ ਮੋੜੀ ਜਾ ਸਕਦੀ ਹੈ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਸੈਲਫ ਹੈਲਪ ਗਰੁੱਪਾਂ ਰਾਹੀਂ ਕਈ ਤਰ੍ਹਾਂ ਦੀਆਂ ਨਵੀਆਂ ਨਵੀਆਂ ਸਕੀਮਾਂ ਰਾਹੀਂ ਆਉਂਦੇ ਹਨ ਔਰਤਾਂ ਇਸ ਵਿੱਚ ਰੁਜ਼ਗਾਰ ਦੇ ਮੌਕੇ ਲੱਭਦੀਆਂ ਹਨ ਅਤੇ ਉਹਨਾਂ ਨੂੰ ਗ੍ਰਹਿਣ ਵੀ ਕਰਦੀਆਂ ਹਨ ਜਿਸ ਕਰਕੇ ਉਹਨਾਂ ਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਪੈਂਦੀ ਦੂਸਰਾ ਉਹ ਆਮ ਜਨਤਾ ਵਿੱਚ ਵਿਆਜ ਦੀਆਂ ਦਰਾਂ ਜ਼ਿਆਦਾ ਭਰਨ ਦੇ ਲਈ ਮਜਬੂਰ ਨਹੀਂ ਹੁੰਦੀਆਂ ਕਿਉਂਕਿ ਸਰਕਾਰੀ ਪੈਸਾ ਬਹੁਤ ਹੀ ਘੱਟ ਵਿਆਜ ਉੱਪਰ ਇਹਨਾਂ ਦੀ ਮਦਦ ਕਰਦਾ ਹੈ ਧੰਨਵਾਦ